ਸਾਡੇ ਖੇਤਰ ਵਿੱਚ ਕਾਫੀ ਮਸ਼ਹੂਰ ਬਾਜ਼ਾਰ ਹਨ ਜਿਵੇਂ ਕਿ ਹਾਰ ਬਾਜ਼ਾਰ ਅੰਮ੍ਰਿਤਸਰ ਐਤਵਾਰ ਨੂੰ ਕੱਪੜੇ ਅਤੇ ਬੂਟਾਂ ਦੀ ਸੇਲ ਲੱਗਦੀ ਹੈ ਅਤੇ ਹੋਰ ਕਾਫੀ ਚੀਜ਼ਾਂ ਦੀ ਸੇਲ ਵੀ ਲੱਗਦੀ ਹੈ ਅਤੇ ਕਟੜਾ ਜੈਮਲ ਸਿੰਘ ਵਿੱਚ ਵੀ ਸੋਮਵਾਰ ਨੂੰ ਕੱਪੜੇ ਦੀ ਸੇਲ ਲੱਗਦੀ ਹੈ ਜਿਸ ਨੂੰ ਸੋਮ ਬਾਜ਼ਾਰ ਵੀ ਕਹਿ ਦਿੰਦੇ ਹਾਂ ਇੱਥੇ ਕਈ ਪਾਸੋਂ ਸੈਲਾਨੀ ਵੀ ਆਉਂਦੇ ਹਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਲੋਕ ਆਉਂਦੇ ਹਨ ਸਾਡੇ ਲਾਗੇ ਅਨਾਜ ਮੰਡੀ ਭਗਤਾਂ ਵਾਲਾ ਜੰਡਿਆਲਾ ਅਤੇ ਵੱਲਾ ਸਬਜ਼ੀ ਮੰਡੀ ਵੀ ਹੈ ਇੱਥੇ ਹਰ ਰੋਜ਼ ਸਬਜ਼ੀ ਮੰਡੀ ਲੱਗਦੀ ਹੈ ਅਤੇ ਇੱਥੇ ਹਰ ਇੱਕ ਚੀਜ਼ ਦੀ ਕੀਮਤ ਘੱਟ ਹੁੰਦੀ ਹੈ ਅਤੇ ਬਹੁਤ ਹੀ ਵਧੀਆ ਹੁੰਦੀ ਹੈ ਜੋ ਹਰ ਕੋਈ ਆਸਾਨੀ ਨਾਲ ਖਰੀਦਦਾਰੀ ਕਰਦਾ ਹੈ